ਹੈਲੋ ਹਾਂ ਸਰ ਅਸੀਂ ਨਨਕਾਣਾ ਸਾਹਿਬ ਜਾਣਾ ਤੁਸੀਂ ਅ ਟਰੈਵਲਿੰਗ ਏਜੰਟ ਗੱਲ ਕਰ ਰਹੇ ਹੋ ਓਕੇ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਵੇਂ ਜਾ ਸਕਦੇ ਹਾਂ ਕੀ ਕੀ ਕਰਨਾ ਪਵੇਗਾ ਨਨਕਾਣਾ ਸਾਹਿਬ ਜਾਣ ਲਈ ਕੀ ਕੁਛ ਮਤਲਬ ਡਾਕੂਮੈਂਟ ਪਵੇਗਾ ਠੀਕ ਹੈ ਅਤੇ ਇਹ ਕਿੱਥੇ ਬਣੇਗਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਮਤਲਬ ਸਾਨੂੰ ਉੱਥੇ ਜਾਣ ਦੀ ਤਾਂ ਨਹੀਂ ਲੋੜ ਪੈਣੀ ਹਾਂਜੀ ਹਾਂਜੀ ਮਤਲਬ ਪੈਸੰਜਰ ਠੀਕ ਹੈ ਪਚਾਸੀ ਸੌ ਰੁਪਈਆ ਔਰ ਫੈਮਲੀ ਮਤਲਬ ਫੈਮਲੀ 'ਚੋਂ ਕਿੰਨੀ ਕੁ ਏਜ਼ ਤੱਕ ਦੇ ਜਾ ਸਕਦੇ ਹਾਂ ਮਤਲਬ ਕੁਛ ਇਹੋ ਜਿਹਾ ਕੁਛ

ਅੱਛਾ ਅਗਰ ਜੇ ਬੱਚਿਆਂ ਨੂੰ ਲੈ ਜਾਣਾ ਹੋਵੇ ਤਾਂ ਕੋਈ ਏਜ਼ ਊਜ਼ ਦਾ ਇਸ਼ੂ ਤਾਂ ਨਹੀਂ ਹੈ ਠੀਕ ਹੈ ਔਰ ਕੁਛ ਹੋਰ ਤੁਸੀਂ ਦੱਸ ਸਕਦੇ ਹੋ ਵੀ ਨਨਕਾਣਾ ਸਾਹਿਬ ਤੋਂ ਕੀ ਕੁਛ ਦੇਖਣ ਨੂੰ ਮਿਲ ਸਕਦਾ ਜਾਂ ਮਤਲਬ ਕਿੱਥੇ ਕਿੱਥੇ ਤੁਸੀਂ ਘੁਮਾਓਂਗੇ ਹਾਂਜੀ ਹਾਂਜੀ ਓਕੇ ਹਾਂਜੀ ਹਾਂਜੀ ਓਕੇ ਮਤਲਬ ਸਿਰਫ ਪਚਾਸੀ ਸੌ ਜਾਂ ਪਚਾਸੀ ਤੋਂ ਸੌ ਕੁ ਵੱਧ ਕੁਛ ਟਿਕਟ ਅੱਛਾ ਪਚਾਸੀ ਸੌ ਟਿਕਟ ਹੈ ਨਾ ਤੁਸੀਂ ਪਚਾਸੀ ਸੌ ਦੱਸ ਠੀਕ ਹੈ ਓਕੇ ਸਰ ਚਲੋ ਦੇਖਦੇ ਹਾਂ ਅਸੀਂ ਫੈਮਲੀ ਨਾਲ ਗੱਲ ਕਰਕੇ ਦੇਖਦੇ ਹੈ